ਹਾਂਜੀ ਅਸੀਂ ਸੋਚਦੇ ਹਾਂ ਵੀ ਮੀਡੀਆ 'ਤੇ ਸਿੱਖਿਆ ਪ੍ਰਣਾਲੀ 'ਚ ਪੰਜਾਬੀ ਭਾਸ਼ਾ ਨੂੰ ਉਚਿਤ ਰੂਪ 'ਚ ਦਰਸਾਇਆ ਗਿਆ ਹੈ ਜਿਵੇਂ ਕਿ ਵੀ ਕੋਈ ਜਿਹੜੀ ਮੀਡੀਆ ਵਾਲੇ ਹੁੰਦੇ ਹੈਗੇ ਉਹ ਹਰ ਇਕ 'ਚ ਪੰਜਾਬੀ ਬੋਲਦੇ ਨੇ ਜਿਹੜੇ ਲੋਕ ਅਨਪੜ੍ਹ ਹੁੰਦੇ ਨੇ ਜਿਹੜੇ ਸਮਝ ਨਹੀਂ ਸਕਦੇ ਹੈਗੇ ਗੇ ਉਹ ਪੰਜਾਬੀ ਨੂੰ ਚੰਗੀ ਤਰੀਕੇ ਨਾਲ ਤਰੀਕੇ ਨਾਲ ਸਮਝ ਸਕਦੇ ਨੇ ਕਿਉਂਕਿ ਜਿਹੜੇ ਮੀਡੀਆ ਵਾਲੇ ਹੁੰਦੇ ਨੇ ਉਹ ਪੰਜਾਬੀ ਹਰੇਕ ਚੈਨਲ ਪੰਜਾਬੀ ਦੇ ਵਿੱਚ ਹੁੰਦਾ ਹੀ ਹੈ ਜਿਹਦੇ ਵਿੱਚ ਕਿ ਉਹ ਪੰਜਾਬੀ ਬੋਲਦੇ ਨੇ ਅਤੇ ਜਿਹੜੇ ਗਾ ਵੇਖਦੇ ਹੈਗੇ ਖਬਰਾਂ ਸੁਣਦੇ ਹੈਗੇ ਉਹਨਾਂ ਨੂੰ ਸਮਝਣ ਦੇ ਵਿੱਚ ਪੂਰੀ ਵਧੀਆ ਆਸਾਨੀ ਹੋ ਜਾਂਦੀ ਹੈ ਅਤੇ ਜੇ ਸਿੱਖਿਆ ਪ੍ਰਣਾਈ 'ਚ ਵੀ ਪੰਜਾਬੀ ਭਾਸ਼ਾ ਨੂੰ ਬਹੁਤ ਉੱਚੇ ਰੂਪ 'ਚ ਦਰਸਾਇਆ ਗਿਆ ਜਿਵੇਂ ਕਿ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਬੱਚੇ ਦੇ ਲਈ ਪੰਜਾਬੀ ਦਾ ਹੋਣਾ ਲਾਜ਼ਮੀ ਹੈ ਹਰ ਇੱਕ ਸਬਜੈਕਟ 'ਚ ਪੰਜਾਬੀ ਹੁੰਦੀ ਹੁੰਦੀ ਹੈਗੀ ਜਿਹੜਾ ਪੰਜਾਬੀ ਸਬਜੈਕਟ ਲਾਜ਼ਮੀ ਦਿੱਤਾ ਹੋਇਆ ਹੈਗਾ ਗਾ ਜਿਵੇਂ ਕਿ ਬੱਚੇ ਨੇ ਪੰਜਾਬੀ ਦੇ ਵਿੱਚ ਵਧੀਆ ਪੜ੍ਹ ਸਕਦੇ ਹੈਗੇ ਘਰਾਂ ਅੱਜ ਕੱਲ੍ਹ ਘਰਾਂ ਦੇ ਵਿੱਚ ਹੀ ਬੱਚੇ ਜਿਹੜੇ ਪੰਜਾਬੀ ਸਿੱਖਦੇ ਹੈਗੇ ਸ਼ੁਰੂ ਤੋਂ ਹੀ ਇਸ ਪੰਜਾਬੀ ਸਿੱਖਦੇ ਨੇ